ਮੈਂ ਪਿੰਡ ਵਿੱਚ ਰਹਿੰਦੀ ਹਾਂ ਅਤੇ ਸਾਡੇ ਘਰ ਦਾ ਮਾਹੌਲ ਬਹੁਤ ਹੀ ਵਧੀਆ ਹੈ ਬਹੁਤ ਖੁੱਲ੍ਹਾ ਵਾਤਾਵਰਨ ਹੈ ਸਾਡਾ ਘਰ ਇੱਕ ਕਨਾਲ ਵਿੱਚ ਬਣਿਆ ਹੋਇਆ ਜਿਸ ਵਿੱਚ ਆਪਾਂ ਗਾਵਾਂ ਮੱਝਾਂ ਅਤੇ ਕੁੱਤੇ ਵੀ ਰੱਖੇ ਹੋਏ ਹਨ ਪਰ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਸੀਂ ਟੀਕਾਕਰਨ ਪੂਰੇ ਟਾਈਮ 'ਤੇ ਗਾਵਾਂ ਨੂੰ ਅਤੇ ਅਤੇ ਮੱਝਾਂ ਨੂੰ ਕਰਵਾਉਂਦੇ ਹਨ ਗਾਵਾਂ ਅਤੇ ਮੱਝਾਂ ਦੇ ਲਈ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਉਹਨਾਂ ਦਾ ਵੱਖਰਾ ਘਰ ਬਣਾਇਆ ਹੋਇਆ ਹੈ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਹੈ ਕੁੱਤਿਆਂ ਦਾ ਟੀਕਾਕਰਨ ਵੀ ਪ੍ਰੋਪਰ ਕੀਤਾ ਜਾਂਦਾ ਹੈ ਅਤੇ ਘਰ ਵਿੱਚ ਪੂਰੀ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਪਸ਼ੂ ਭਲਾਈ ਲਈ ਆਪਾਂ ਪਸ਼ੂ ਦੀ ਦੇਖਭਾਲ ਲਈ ਪੂਰਾ ਡਾਕਟਰ ਇੱਕ ਰੱਖਿਆ ਹੋਇਆ ਹੈ ਜਿਹੜਾ ਕਿ ਹਰ ਮਹੀਨੇ ਪਸ਼ੂਆਂ ਦੇ ਚੈਕਅਪ ਲਈ ਘਰ ਆਉਂਦਾ ਹੈ ਅਤੇ ਉਹਨਾਂ ਦਾ ਟੀਕਾਕਰਨ ਹਰ ਤਰੀਕੇ ਦੇ ਨਾਲ ਕਰਦਾ ਹੈ ਕੁੱਤਿਆਂ ਦੇ ਲਈ ਵੀ ਸਾਡਾ ਡਾਕਟਰ ਆਉਂਦਾ ਹੈ ਅਤੇ ਕੁੱਤਿਆਂ ਦੀ ਬਹੁਤ ਸਫਾਈ ਰੱਖਦਾ ਹੈ ਬਾਕੀ ਜਾਨਵਰਾਂ ਨੂੰ ਸੰਭਾਲ ਰੱਖਣ ਲਈ ਉਹਨਾਂ ਦਾ ਵੱਖਰਾ ਹੀ ਕਮਰਾ ਹੈ ਅਤੇ ਉਹਨਾਂ ਦੇ ਬਰਤਨ ਵੀ ਵੱਖਰੇ ਹਨ ਅਤੇ ਉਹਨਾਂ ਨੂੰ ਦਵਾਈ ਦਾ ਪ੍ਰੋਪਰ ਇਲਾਜ ਕੀਤਾ ਜਾਂਦਾ ਹੈ ਅਤੇ ਆਪਾਂ ਯੂਟਿਊਬ ਦੇ ਦੁਆਰਾ ਅਸੀਂ ਜਾਣਕਾਰੀ ਲੈਂਦੇ ਹਾਂ ਅਤੇ ਸਭ ਤੋਂ ਵਧੀਆ ਜਾਣਕਾਰੀ ਯੂਟਿਊਬ ਅਤੇ ਕਿਤਾਬਾਂ ਦੇ ਦੁਆਰਾ ਅਸੀਂ ਜਾਣਕਾਰੀ ਲੈਂਦੇ ਹਾਂ ਕਿ ਇਹਨਾਂ ਦੀ ਸ਼ਕਸ਼ਾ ਵਾਸਤੇ ਹੋਰ ਕਿਹੜੇ ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ